ਸਰਕਾਰ ਵੱਲੋਂ ਵੈਸੇ ਤਾਂ ਹਰ ਸਾਲ ਹੀ ਸਰਕਾਰ ਵੱਲੋਂ ਵੈਸੇ ਤਾਂ ਹਰ ਸਾਲ ਹੀ ਸਾਨੂੰ ਸਹੂਲਤਾਂ ਮਿਲਦੀਆਂ ਹਨ ਦਿੱਤੀਆਂ ਜਾਂਦੀਆਂ ਹਨ ਜਿਵੇਂ ਕਿ ਜਨ ਧਨ ਸਹੂਲਤ ਲਾਕਡਾਊਨ ਦੇ ਵਿੱਚ ਜੋ ਕਿ ਮੋਦੀ ਪ੍ਰਧਾਨ ਮੰਤਰੀ ਦੇ ਖਾਤੇ ਖੁੱਲ੍ਹਵਾਏ ਸਨ ਉਹਨਾਂ ਵਿੱਚ ਹਰ ਇੱਕ ਵਿਅਕਤੀ ਨੂੰ ਮਹੀਨੇ ਦਾ ਪੰਜ ਸੌ ਪੰਜ ਸੌ ਆਇਆ ਸੀ ਜਿਵੇਂ ਕਿ ਦੇਸ਼ ਉੱਤੇ ਕੋਈ ਵੀ ਪ੍ਰੋਬਲਮ ਪ੍ਰੇਸ਼ਾਨੀ ਆਉਂਦੀ ਹੈ ਉਹਦੇ ਵਿੱਚ ਸਾਨੂੰ ਉਸ ਸਰਕਾਰੀ ਜੋ ਕਿ ਖਾਤਾ ਹੁੰਦਾ ਹੈ ਸਰਕਾਰ ਵਜੋਂ ਖਲਵਾਇਆ ਜਾਂਦਾ ਹੈ ਸਾਡਾ ਸਰਕਾਰ ਵਜੋਂ ਜੋ ਖਾਤਾ ਖੁੱਲ੍ਹਵਾਇਆ ਜਾਂਦਾ ਹੈ ਸਰਕਾਰੀ ਉਹਦੇ ਵਿੱਚ ਪੈਸੇ ਪਾਏ ਜਾਂਦੇ ਹਨ ਜਿਵੇਂ ਕਿ ਲੋਕਡਾਊਨ ਦੇ ਵਿੱਚ ਬਹੁਤ ਹੀ ਸਾਰਿਆਂ ਹਰ ਇੱਕ ਨੂੰ ਸਹੂਲਤਾਵਾਂ ਮਿਲੀ ਸੀ ਉਸ ਪੰਜ ਸੌ ਪੰਜ ਸੌ ਦੀ ਮੇਰੀ ਮੇਰਾ ਵੀ ਸੀਗਾ ਮੇਰੀ ਵਾਈਫ ਨੇ ਵੀ ਖੁੱਲ੍ਹਵਾਇਆ ਸੀ ਕਿ ਜਿਹਦੇ ਵਿੱਚ ਸਾਰਿਆਂ ਨੇ ਅਸੀਂ ਸਾਡੇ ਲਾਗੇ ਬੰਨੇ ਹਰ ਇੱਕ ਨੇ ਲਾਭ ਪ੍ਰਾਪਤ ਕੀਤਾ ਸਰਕਾਰੀ ਹਰ ਇੱਕ ਸੇਵਾਵਾਂ ਦਾ ਲਾਭ ਉਠਾਉਣਾ ਚਾਹੀਦਾ ਹੈ ਹਰ ਇੱਕ ਨੂੰ